ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਹਲੀ ਸਵੀਟ ਤੋਂ ਗੱਲ ਕਰ ਰਹੇ ਹੋ ਜੀ ਠੀਕ ਹੈ ਜੀ ਅਤੇ ਮੈਂ ਭਾਅ ਜੀ ਆਪਣਾ ਬੋਲ ਰਿਹਾਂ ਸਰਹੰਦ ਤੋਂ ਅਤੇ ਮੇਰੇ ਅੱਜ ਬ੍ਰਦਰ ਦਾ ਹੈਗਾ ਬਰਡੇ ਅਤੇ ਮੈਂ ਐਕੁਚਲੀ ਅੱਜ ਜਾ ਨਹੀਂ ਸਕਦਾ ਅਤੇ ਉੱਥੇ ਫਿਰ ਮੈਂ ਕੇਕ ਭਿਜਵਾਉਣਾ ਤੁਹਾਡਾ ਡਿਲੀਵਰੀ ਕਰਵਾਉਣੀ ਆ ਤੁਹਾਡੇ ਤੋਂ ਹਾਂਜੀ ਹਾਂਜੀ ਹਾਂਜੀ ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਅਵੇਲੇਬਲ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਸਰ ਆਪਾਂ ਨੂੰ ਇੱਕ ਸਟੋਬੇਰੀ ਫਿਰ ਕਰ ਦਿਉ ਡੇਢ ਕੁ ਪਉਣ ਦਾ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਚੰਗੀ ਤਰ੍ਹਾਂ ਐਨ ਉੱਪਰ ਨਾਮ ਲਿਖਣਾ ਤੁਸੀਂ ਉਹਨਾਂ ਦਾ ਠੀਕ ਹੈ ਜੀ ਰਣਜੀਤ ਨਾਮ ਲਿਖ ਦਿਓ ਜੀ ਰਣਜੀਤ ਬੱਗੂ ਹਾਂ ਆਰ ਏ ਐੱਨ ਜੇ ਆਈ ਟੀ ਬੀ ਯੂ ਜੀ ਯੂ ਹਾਂਜੀ ਇਹ ਅਲੱਗ ਲਿਖਣਾ ਜੀ ਹਾਂਜੀ ਹਾਂਜੀ ਹਾਂਜੀ ਅਤੇ ਉਹਨੂੰ ਸਾਈਡ 'ਤੇ ਤੁਸੀਂ ਲਿਖ ਦਿਓ ਉਹਨਾਂ ਦੇ ਡੇਟ ਔਫ ਬਰਥ ਲਿਖ ਦਿਓ ਉਹਨਾਂ ਦੀ ਨਹੀਂ ਡੇਟ ਔਫ ਬਰਥ ਰਹਿਣ ਦਿਓ ਤੁਸੀਂ ਤੁਸੀਂ ਉਹਨਾਂ ਦੇ ਈਅਰ ਲਿਖ ਦਿਓ ਹਾਂ ਅਠਾਈ ਈਅਰ ਕੰਪਲੀਟ ਹੋਗੇ ਉਹਨਾਂ ਦੇ ਅਤੇ ਐਕੁਚਲੀ ਮੈਂ ਬ੍ਰਦਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਅਤੇ ਮੈਂ ਐਕੁਚਲੀ ਆ ਨਹੀਂ ਸਕਦਾ ਬਹੁਤ ਵਧੀਆ ਮੇਰਾ ਭਰਾ ਏ ਉਹ ਬੱਸ ਮਜਬੂਰੀ ਇਹੋ ਜਿਹੀ ਫਸ ਗਈ ਵੀ ਨਹੀਂ ਜਾ ਸਕਿਆ ਅਤੇ ਤੁਸੀਂ ਨੇ ਉੱਥੇ ਔਡਰ ਭੇਜਣਾ ਅਤੇ ਨਾਲ ਉਹਨਾਂ ਦੇ ਹੋਰ ਵੀ ਚੀਜ਼ਾਂ ਕੁਛ ਐਡ ਕਰਾ ਰਹਾ ਊ ਅਤੇ ਅੱਠ ਸਮੋਸੇ ਪੈਕ ਕਰਵਾ ਦਿਓ ਤੁਸੀਂ ਆਪਣੇ ਸਪੈਸ਼ਲ ਜਿਹੜੇ ਤੁਸੀਂ ਤਿਆਰ ਕਰਦੇ ਹੁੰਦੇ ਓਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਨਾਲ ਸਰ ਉਹਨਾਂ ਦੇ ਦੋ ਕੋਲਡ ਡਰਿੰਕਸ ਕਰ ਦਿਓ ਤੁਸੀਂ ਐਪੀ ਫੀਜ ਕਰ ਦਿਓ ਅਤੇ ਦੋ ਲੀਟਰ ਕੋਕ ਕਰ ਦਿਓ ਵਧੀਆ ਪੂਰੀ ਤਰ੍ਹਾਂ ਐਨ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਤੁਹਾਡਾ ਬਹੁਤ ਅੱਛਾ ਤੁਹਾਡਾ ਅਪੁ ਕੰਮ ਹੈ ਮੈਨੂੰ ਬਹੁਤ ਪਸੰਦ ਹੈ ਜੀ ਸੋ ਮੈਨੂੰ ਤੁਹਾਡੇ ਤੋਂ ਉਮੀਦ ਹੈ ਵੀ ਤੁਸੀਂ ਜਲਦ ਤੋਂ ਜਲਦ ਉੱਥੇ ਭਿਜਵਾ ਦੋਂਗੇ ਤੁਸੀਂ ਨੇ ਪਟਿਆਲੇ ਪਹਿਚਾਣਾ ਜੀ ਪਤਾ ਹੈਗਾ ਓਮੈਕਸ ਸਿਟੀ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਤੁਹਾਡਾ ਬੰਦਾ ਉੱਥੇ ਆ ਕੇ ਕੋਲ ਕਰ ਲੇਗਾ ਮੈਨੂੰ ਅਤੇ ਮੈਂ ਉੱਥੇ ਭਿਜਵਾ ਦਾਂਗਾ ਬੰਦੇ ਨੂੰ ਅਤੇ ਉੱਥੇ ਔਡਰ ਆ ਜਿਹੜਾ ਹੋਵੇਗਾ ਉਹ ਰਿਸੀਵ ਕਰ ਲੈਣਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ